ਅਠਾਈ ਫਰਵਰੀ ਦੋ ਹਜ਼ਾਰ ਚੌਵੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਦੋ ਜੂਨ ਉੱਨੀ ਸੌ ਚੁਰਾਸੀ ਪੰਦਰ੍ਹਾਂ ਅਗਸਤ ਉੱਨੀ ਸੌ ਨੱਬੇ ਦੋ ਜੂਨ ਉੱਨੀ ਸੌ ਚੁ ਚੁਰਾਨਵੇਂ